ਜੇ ਅਖਬਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਇਲਾਕੇ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਇੰਗਲਿਸ਼ ਹਿੰਦੀ ਪੰਜਾਬੀ ਤਿੰਨ ਤਰ੍ਹਾਂ ਦੇ ਅਖਬਾਰ ਆਉਂਦੇ ਨੇ ਜਿਹਨਾਂ ਦੇ ਵਿੱਚ ਅਜੀਤ ਜਗਬਾਣੀ ਪੰਜਾਬੀ ਟ੍ਰਬਿਊਨ ਆਉਂਦੇ ਨੇ ਅਤੇ ਪਰ ਜੋ ਮੇਰਾ ਪਸੰਦੀਦਾ ਅਖਬਾਰ ਹੈ ਜੋ ਮੈਂ ਪੜ੍ਹਦਾ ਉਹ ਪੰਜਾਬੀ ਟ੍ਰਿਬਿਊਨ ਹੀ ਆ ਮੈਂ ਜ਼ਿਆਦਾਤਰ ਪੰਜਾਬੀ ਟ੍ਰਬਿਊਨ ਪੜ੍ਹ ਕੇ ਰਾਜੀ ਹਾਂ ਅਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਜੋ ਖਬਰਾਂ ਨੇ ਜ਼ਿਆਦਾ ਵਧੀਆ ਅਤੇ ਜ਼ਿਆਦਾ ਫੈਕਟਫੁੱਲ ਹੁੰਦੀਆਂ ਨੇ ਅਤੇ ਇਹ ਅਖਬਾਰ ਮੇਰਾ ਪਸੰਦੀਦਾ ਅਖਬਾਰ ਆ ਅਤੇ ਮੈਂ ਸ਼ੁਰੂ ਤੋਂ ਹੀ ਇਹ ਪੜ੍ਹਦਾ ਅਖਬਾਰ ਅਤੇ ਮੈਨੂੰ ਇਹ ਇਹ ਲੱਗਦਾ ਕਿ ਬਾਕੀ ਅਖਬਾਰਾਂ ਦੇ ਮੁਕਾਬਲੇ ਇਹ ਅਖਬਾਰ ਸ ਜ਼ਿਆਦਾ ਵਧੀਆ ਅਤੇ ਥੈਂਕ ਯੂ ਸੋ ਮਚ